ਹੈਲੋ ਐਮਾਜ਼ੋਨ ਸਤਿ ਸ਼੍ਰੀ ਅਕਾਲ ਜੀ ਮੈਂ ਅਨਮੋਲਪ੍ਰੀਤ ਸਿੰਘ ਮੈਂ ਨਾ ਤੁਹਾਡੀ ਸਾਈਟ ਤੋਂ ਇੱਕ ਐਡੀਡਾਸ ਦੇ ਸ਼ੂਜ਼ ਔਡਰ ਕੀਤੇ ਸੀਗੇ ਹਾਂਜੀ ਮੇਰਾ ਔਡਰ ਨੰਬਰ ਦੋ ਚਾਰ ਛੇ ਸੱਤ ਸੀਗਾ ਹਾਂਜੀ ਮੈਂ ਨਾ ਜੋ ਸ਼ੂਜ਼ ਔਡਰ ਕੀਤੇ ਸੀ ਉਹ ਉਹਨਾਂ ਤੋ ਅਲੱਗ ਸਨ ਡਿਸਪਲੇ 'ਤੇ ਉਹਨਾਂ ਨੇ ਬਲੈਕ ਕਲਰ ਦੇ ਸ਼ੂਜ਼ ਮੈਂ ਔਡਰ ਕੀਤੇ ਸੀਗੇ ਅਤੇ ਜੋ ਮੇਰੇ ਕੋਲ ਆਏ ਉਹ ਥੋੜ੍ਹੇ ਬਰਾਊਨ ਕਲਰ ਦੇ ਸੀਗੇ ਅਤੇ ਡਿਜ਼ਾਇਨ 'ਚ ਵੀ ਥੋੜ੍ਹਾ ਜਿਹਾ ਫ਼ਰਕ ਸੀਗਾ ਚਲੋ ਮੈਂ ਇਸ ਗੱਲ ਨੂੰ ਇਗਨੋਰ ਕੀਤਾ ਮੈਂ ਕਿਹਾ ਚਲੋ ਕੋਈ ਨਾ ਇਹ ਵੀ ਦੇਖਣ ਨੂੰ ਅੱਛੇ ਨੇ ਮੈਂ ਤਾਂ ਵੀ ਉਹ ਪਾ ਲਏ ਪਾਉਣ ਤੋਂ ਦਸ ਗਿਆਰਾਂ ਦਿਨ ਬਾਅਦ ਉਹ ਸ਼ੂਜ਼ ਦੀ ਹਾਲਤ ਬੁਰੀ ਹੋ ਚੁੱਕੀ ਸੀਗੀ ਉਹ ਫਟ ਚੁੱਕੇ ਸਨ ਉਹਨਾਂ ਦਾ ਤਲਾ ਉੱਖੜ ਚੁੱਕਿਆ ਸੀ ਮੈਨੂੰ ਐਡੀਡਾਸ ਤੋਂ ਇਹ ਬਿਲਕੁਲ ਆਸ਼ਾ ਨਹੀਂ ਸੀਗੀ ਹਾਂਜੀ ਮੈਂ ਸਮਝਦਾ ਮੇਰਾ ਪ੍ਰੋਡਕਟ ਵਾਪਸ ਨਹੀਂ ਹੋ ਸਕਦਾ ਕਿਉਂਕਿ ਮੈਂ ਉਹਨੂੰ ਪਹਿਨ ਲਿਆ ਹੈ ਬਟ ਮੈਂ ਐਡੀਡਾਸ ਨੂੰ ਫੀਡਬੈਕ ਦੇਣਾ ਚਾਹੁੰਦਾ ਕਿ ਅੱਗੇ ਤੋਂ ਇੱਦਾਂ ਦੀ ਗਲਤੀ ਨਹੀਂ ਹੋਣੀ ਚਾਹੀਦੀ ਹਾਂਜੀ ਉਹ ਆਪਣੇ ਪ੍ਰੋਡਕਟ ਵਧੀਆ ਕੁਆਲਿਟੀ ਦੇ ਹੀ ਦੇਣ ਅਤੇ ਜੋ ਡਿਸਪਲੇ 'ਤੇ ਸ਼ੋਅ ਕਰਦੇ ਨੇ ਉਹੀ ਪਹੁੰਚਾਉਣ ਮੇਰੇ ਵਰਗੀ ਹਾਲਤ ਕਿਸੇ ਹੋਰ ਗ੍ਰਾਹਕ ਦੀ ਨਹੀਂ ਹੋਣੀ ਚਾਹੀਦੀ